ਮੈਂ ਆਪਣਾ ਟੀਕਾਕਰਨ ਕਰਵਾਉਣ ਲਈ ਸਰਕਾਰੀ ਹਸਪਤਾਲ ਦੇ ਦਿੱਤੇ ਹੋਏ ਨੰਬਰ 'ਤੇ ਕਾਲ ਕਰਕੇ ਉੱਥੋਂ ਦੇ ਅਧਿਕਾਰੀ ਨਾਲ ਗੱਲ ਕਰਦਾ ਹਾਂ ਕਿ ਮੈਂ ਆਪਣਾ ਟੀਕਾਕਰਨ ਕਰਵਾਉਣਾ ਚਾਹੁੰਦਾ ਹਾਂ ਉੱਥੋਂ ਦੇ ਅਧਿਕਾਰੀ ਮੈਨੂੰ ਪੁੱਛਦੇ ਹਨ ਕਿ ਮੈਂ ਕਿਸ ਬਿਮਾਰੀ ਦਾ ਟੀਕਾਕਰਨ ਕਰਵਾਉਣਾ ਹੈ ਮੈਂ ਉਹਨਾਂ ਨੂੰ ਦੱਸਦਾ ਹਾਂ ਕਿ ਮੈਂ ਪੋਲੀਓ ਅਤੇ ਕਰੋਨਾ ਵਾਇਰਸ ਦਾ ਟੀਕਾਕਰਨ ਕਰਵਾਉਣਾ ਹੈ ਉੱਥੋਂ ਦੇ ਅਧਿਕਾਰੀ ਮੈਨੂੰ ਕਹਿੰਦੇ ਹਨ ਕਿ ਇਸ ਇਹਨਾਂ ਟੀਕਾਕਰਨ ਕਰਵਾਉਣ ਲਈ ਮੈਨੂੰ ਸਭ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ ਕਰਵਾਉਣਾ ਪਵੇਗਾ ਜਿਸ ਤਾਂ ਕਿ ਅੱਗੇ ਟੀਕੇਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ ਉਹ ਦੱਸਦੇ ਹਨ ਇਸ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਹੀ ਮੈਨੂੰ ਦੱਸਿਆ ਜਾਵੇਗਾ ਕਿ ਕਿਸ ਦਿਨ ਅਤੇ ਕਿਸ ਸਮੇਂ ਮੇਰਾ ਇੰਨਾ ਬਿਮਾਰੀਆਂ ਦਾ ਟੀਕਾਕਰਨ ਹੋਵੇਗਾ ਤਾਂ ਕਿ ਪੂਰੀ ਰਜਿਸਟਰੇਸ਼ਨ ਤੋਂ ਬਾਅਦ ਹੀ ਜਾਣਕਾਰੀ ਪ੍ਰਾਪਤ ਹੋ ਸਕੇਗੀ